ਦੇਸ਼ਾਂ ਵਿੱਚ ਭਸ਼ਾਵਾਂ ਦਾ ਇੱਕ ਮਹੱਤਵਪੂਰਨ ਸਥਾਨ ਹੁੰਦਾ ਹੈ ਜੋ ਸਮਾਜ ਅਤੇ ਸੰਸਾਰਿਕ ਜੋੜ ਨੂੰ ਸਮਝਣ ਵਿੱਚ ਮਦਦਗਾਰ ਹੁੰਦਾ ਹੈ ਇਸ ਦਾ ਇਹ ਮਤਲਬ ਨਹੀਂ ਕਿ ਜੇ ਇੱਕ ਦੇਸ਼ ਵਿੱਚ ਇੱਕ ਭਾਸ਼ਾ ਬੋਲੀ ਜਾਂਦੀ ਹੈ ਤਾਂ ਹੋਰ ਦੇਸ਼ਾਂ ਵਿੱਚ ਉਹ ਨਹੀਂ ਬੋਲੀ ਜਾਂਦੀ ਸਾਰੇ ਭਾਸ਼ਾਵਾਂ ਆਪਣੀ ਮਹੱਤਤਾ ਰੱਖਦੀਆਂ ਹਨ ਅਤੇ ਸਾਨੂੰ ਸਭ ਦਾ ਸਨਮਾਨ ਕਰਨਾ ਚਾਹੀਦਾ ਆ ਭਾਰਤ ਵਿੱਚ ਸਰਕਾਰੀ ਭਾਸ਼ਾ ਹੈ ਹਿੰਦੀ ਪਰ ਭਾਰਤ ਦੇ ਵਿੱਚ ਕਈ ਹੋਰ ਭਾਸ਼ਾਵਾਂ ਵੀ ਬੋਲੀਆਂ ਜਾਂਦੀਆਂ ਹਨ ਹਰ ਪ੍ਰਾਂਤ ਦੇ ਅਤੇ ਖੇਤਰ ਦੀ ਵਿਭਿੰਨਤਾ ਅਨੁਸਾਰ ਭਾਸ਼ਾਵਾਂ ਦੇ ਉਪਯੋਗ ਵਿੱਚ ਵਰਤਿਆ ਜਾਂਦਾ ਹੈ ਪੰਜਾਬ ਵਿੱਚ ਪੰਜਾਬੀ ਪੰਜਾਬ ਦੀ ਆਵਾਜ਼ ਹੈ ਪਰ ਇੱਥੇ ਵੀ ਹਿੰਦੀ ਬੋਲੀ ਜਾਂਦੀ ਹੈ ਅਤੇ ਹਰ ਇੱਕ ਨੂੰ ਆਪਣੀ ਭਾਸ਼ਾ 'ਚ ਗੱਲ ਕਰਨ ਦਾ ਹੱਕ ਹੈ ਪੰਜਾਬੀ ਭਾਸ਼ਾ ਦੇ ਵਿਕਾਸ ਵਿੱਚ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਯੋਗਦਾਨ ਦਾ ਬਹੁਤ ਵੱਡਾ ਮਹੱਤਵ ਹੈ ਜਿਨ੍ਹਾਂ ਨੇ ਪੰਜਾਬੀ ਭਾਸ਼ਾ ਦੀ ਗੁਰਮੁਖੀ ਲਿਪੀ ਵਿੱਚ ਸ਼ੁੱਧ ਕਰਕੇ ਇਸ ਨੂੰ ਵਿਸ਼ੇਸ਼ ਪਹੁੰਚ ਦਿੱਤੀ ਪੰਜਾਬ ਦੇ ਹੋਰ ਮਹਾਨ ਕਵੀਆਂ ਅਤੇ ਸੰਤਾਂ ਨੇ ਵੀ ਇਸ ਭਾਸ਼ਾਵਾਂ ਦੀ ਉੱਚੇ ਦਰਜੇ ਦੀ ਤਰਕਸ਼ੀਲ ਬਣੇ ਸਮੇਂ ਦੇ ਨਾਲ ਨਾਲ ਪੰਜਾਬੀ ਭਾਸ਼ਾ ਵੀ ਅੱਗੇ ਵਧੀ ਤਕਨੀਕੀ ਵਿਸ਼ੇਸ਼ਤਾ ਅਤੇ ਕਾਰਗਰ ਸੰਦੇਸ਼ਾਂ ਦੇ ਜ਼ਰੀਏ ਇਸ ਨੂੰ ਵਧੇਰੇ ਲੋਕਾਂ ਤੱਕ ਪਹੁੰਚਾਇਆ ਗਿਆ ਹੈ ਆਧੁਨਿਕ ਯੁੱਗ ਵਿੱਚ ਇਹਨਾਂ ਦੀ ਪ੍ਰੋਫੈਸ਼ਨਲ ਵਰਤੋਂ ਅਤੇ ਵੈਸਟਰਨ ਸਮਾਜ ਦੀ ਪ੍ਰਭਾਵਿਤ ਪ੍ਰਵਾਹ ਨੇ ਪੰਜਾਬੀ ਭਾਸ਼ਾ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਹੈ ਪੰਜਾਬੀ ਭਾਸ਼ਾ ਹੁਣ ਇੱਕ ਗਲੋਬਲ ਵਿਚਾਰਧਾਰਾ ਦੇ ਹਿੱਸੇ ਵਿੱਚ ਆ ਚੁੱਕੀ ਹੈ ਇਸ ਨੂੰ ਇੰਟਰਨੈੱਟ ਅਤੇ ਸੋਸ਼ਲ ਮੀਡੀਆ ਦੇ ਜ਼ਰੀਏ ਦੁਨੀਆ ਭਰ ਵਿੱਚ ਪਹੁੰਚਾਇਆ ਜਾ ਰਿਹਾ ਹੈ ਇਹ ਭਾਸ਼ਾ ਨਵੀਂ ਤਕਨੀਕ ਅਤੇ ਨਵੇਂ ਤਰੀਕੇ 'ਤੇ ਸਾਡੀ ਸੋਚ ਨੂੰ ਰੂਪਾਂਤਰਿਤ ਕਰ ਰਹੀ ਹੈ ਇਸ ਤਰ੍ਹਾਂ ਪੰਜਾਬੀ ਭਾਸ਼ਾ ਦੀ ਸਮਾਜ ਅਤੇ ਤਕਨੀਕੀ ਉਭਾਰ ਵਿੱਚ ਆਪਣੇ ਨਾਮ ਨੂੰ ਚਮਕਾਇਆ ਹੈ ਅਤੇ ਸਾਨੂੰ ਗ੍ਰੇਟ ਅਨੁਭਵਾਂ ਨੂੰ ਪ੍ਰਾਪਤ ਕਰਨ ਦਾ ਸੁਨਹਿਰੀ ਅਵਸਰ ਦਿੱਤਾ ਹੈ